ਅੱਜ ਆਪਾਂ ਗੱਲਬਾਤ ਕਰਦੇ ਹਾਂ ਨੈਵੀਗੇਸ਼ਨ ਕਰਨ ਲਈ ਕਿਹੜੀਆਂ ਕਿਹੜੀਆਂ ਅਸੀਂ ਐਪਲੀਕੇਸ਼ਨਾਂ ਦੀ ਅਸੀਂ ਵਰਤੋਂ ਕਰਦੇ ਹਨ ਉਨ੍ਹਾਂ ਨੇ ਸਾਡੇ ਜੀਵਨ ਨੂੰ ਕਿਹਨਾਂ ਤਰੀਕਿਆਂ ਨਾਲ ਅਸਾਨ ਬਣਾਇਆ ਹੈ ਗੱਲ ਕਰਦੇ ਹਾਂ ਆਪਾਂ ਸਭ ਤੋਂ ਪਹਿਲਾਂ ਗੂਗਲਸ ਮੈਪ ਦੀ ਗੂਗਲਸ ਮੈਪ ਇੱਕ ਇੱਦਾਂ ਦੀ ਐਪ ਆ ਜਿਹੜੀ ਸਾਨੂੰ ਦਿਸ਼ਾ ਨਿਰਦੇਸ਼ ਦੇਣ ਵਾਲੀ ਗਲੀ ਮੋੜ ਸਮੇਂ ਦੀ ਜਾਣਕਾਰੀ ਟਰੈਫਕ ਦੀ ਜਾਣਕਾਰੀ ਇਹ ਸਾਰਾ ਕੁਛ ਅਸੀਂ ਕੀ ਹੈ ਗੂਗਲ ਦੇ ਉੱਤੇ ਸਰਚ ਕਰ ਸਕਦੇ ਹਾਂ ਉਹ ਲੋਕੇਸ਼ਨ ਅਸੀਂ ਲਾਉਣੀ ਹੈਗੀ ਗੂਗਲ ਮੈਪ 'ਤੇ ਅਸੀਂ ਐਥੋਂ ਲੋਕੇਸ਼ਨ ਲਗਾ ਲਈ ਅਤੇ ਉਹਦਾ ਸਾਨੂੰ ਸਾਰਾ ਕੁਛ ਐਥੇ ਬੈਠੇ ਪਤਾ ਲੱਗ ਜਾਊਗਾ ਕਿੰਨਾ ਸਮਾਂ ਲੱਗੂਗਾ ਗਲੀ ਮੋੜ ਕਿਹੜੇ ਕਿਹੜੇ ਆ ਰਹੇ ਆ ਕਿੱਧਰ ਦੀ ਜਾਣਾ ਅਸੀਂ ਕਿੱਧਰ ਦੀ ਨਹੀਂ ਜਾਣਾ ਦੂਸਰਾ ਸਾਡੇ ਕੋਲ ਕੀ ਹੈ ਜੀ ਪੀ ਐੱਸ ਹੈ ਇੱਕ ਗਲੋਬਲਿੰਗ ਪੋਜੀਸ਼ਨਿੰਗ ਸਿਸਟਮ ਇਹ ਅੱਜ ਕੱਲ੍ਹ ਆਰਮੀ ਦੇ ਵਿੱਚ ਇਹਨਾਂ ਦਾ ਬਹੁਤ ਇਸਤੇਮਾਲ ਕੀਤਾ ਜਾਂਦਾ ਇਸਤੇਮਾਲ ਦੇ ਦੌਰਾਨ ਕੀ ਹੈ ਸਾਨੂੰ ਪੰਜ ਤਰੀਕਿਆਂ ਦੇ ਨਾਲ ਸਾਨੂੰ ਇਹ ਇਹਦਾ ਅਸੀਂ ਇਸਤੇਮਾਲ ਕਰਦੇ ਹਾਂ ਜਿਵੇਂ ਕਿ ਤੁਸੀਂ ਪਹਿਲਾਂ ਲਾ ਲਓ ਲੋਕੇਸ਼ਨ ਅਸੀਂ ਮੰਨ ਲਓ ਵੀ ਇੱਥੋਂ ਬਠਿੰਡੇ ਤੋਂ ਜੰਮੂ ਜਾਣਾ ਅਸੀਂ ਲਕੇਸ਼ਨ ਭਰ ਲਵਾਂਗੇ ਉਹ ਸਾਨੂੰ ਰੂਟ ਵੀ ਦੱਸ ਦਊਗਾ ਰਸਤਾ ਸਮਾਂ ਕਿੰਨਾ ਲੱਗੂਗਾ ਕਿੱਧਰ ਦੀ ਜਾਣਾ ਅਸੀਂ ਕਿੰਨੇ ਘੰਟੇ ਦਾ ਰਸਤਾ ਹੈ ਇਹ ਸਾਰਾ ਕੁਛ ਕੀ ਹੈ ਸਾਨੂੰ ਜੀ ਪੀ ਐੱਸ ਦੀ ਮਦਦ ਦੇ ਨਾਲ ਇਹਨੇ ਸਾਨੂੰ ਅਸਾਨ ਕਰਤਾ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਜਾਣਾ ਦੂਜਾ ਕੰਮ ਕੀ ਹੈ ਇਹ ਅਤੇ ਅਸੀਂ ਨੈਵੀਗੇਸ਼ਨ ਕਰ ਸਕਦੇ ਹਾਂ ਤੀਸਰਾ ਹੈ ਟਰੈਕਿੰਗ ਨੰਬਰ ਚਾਰ ਮੈਪਿੰਗ ਜੀ ਪੀ ਐੱਸ ਦੇ ਨਾਲ ਅਸੀਂ ਕੀ ਹੈ ਪੂਰੇ ਵਰਲਡ ਦੀ ਪੂਰੇ ਸੰਸਾਰ ਦੀ ਜਿਹੜਾ ਮੈਪ ਆ ਨਕਸ਼ਾ ਉਹਨੂੰ ਕੀ ਹੈ ਦੇਖ ਸਕਦੇ ਹਾਂ ਨੰਬਰ ਪੰਜ ਕੀ ਆ ਇਹਦੇ ਨਾਲ ਕੀ ਆ ਜੀ ਪੀ ਐੱਸ ਦੇ ਨਾਲ ਸਮੇਂ ਦੀ ਬਹੁਤ ਬੱਚਤ ਹੁੰਦੀ ਹੈ ਜਿਹੜਾ ਟੈਮ ਹੈਗਾ ਇਹ ਇਹ ਤੋਂ ਸਾਨੂੰ ਸਮੇਂ ਦਾ ਵੀ ਪਤਾ ਲੱਗ ਜਾਂਦਾ ਜੀ ਪੀ ਐੱਸ ਦੇ ਨਾਲ ਦੇਖੋ ਕਿਸੇ ਵੀ ਜਗ੍ਹਾ 'ਤੇ ਅਸੀਂ ਜਾ ਰਹੇ ਹੈਗੇ ਉਹਦਾ ਅਸੀਂ ਕੀ ਹੈ ਜੀ ਆਰ ਮੰਨ ਲਓ ਅਸੀਂ ਓਨ ਪਜੀਸ਼ਨ ਕੱਢਣੀ ਆਂ ਓਥੋਂ ਦਾ ਅਸੀਂ ਗਰਿੱਡ ਰੈਫਰੈਂਸ ਲੈਣਾ ਸਾਨੂੰ ਐਕੁਰੇਟ ਉਹ ਜਿਹੜਾ ਨਕਸ਼ੇ ਦੇ ਉੱਤੇ ਆ ਫੋਰ ਫਿੱਗਰ ਜਾਂ ਸਿਕਸ ਫਿੱਗਰ ਉਹਦੇ ਹਿਸਾਬ ਦੇ ਨਾਲ ਸਾਨੂੰ ਕੀ ਆ ਉਹ ਜੀ ਪੀ ਐੱਸ ਦੀ ਮਦਦ ਦੇ ਨਾਲ ਓਥੋਂ ਦੇ ਸਾਨੂੰ ਰੈਫਰੈਂਸ ਬਾਰੇ ਪਤਾ ਲੱਗ ਜਾਊਗਾ ਵੀ ਅਸੀਂ ਕਿਹੜੀ ਜਗ੍ਹਾ 'ਤੇ ਖੜ੍ਹੇ ਹਾਂ ਕਿੱਥੇ ਖੜ੍ਹੇ ਹਾਂ ਅਸੀਂ ਚਾਹੇ ਤੁਸੀਂ ਮੈਪ ਦੇ ਉੱਤੇ ਵੀ ਦੇਖ ਲਓ ਉਹਨੂੰ ਤੁਹਾਨੂੰ ਸਾਰਾ ਕੁਛ ਉਹ ਦਿਖਾਈ ਦਊਗਾ ਪਰ ਜੀ ਪੀ ਐੱਸ ਨੇ ਬਿਲਕੁਲ ਤੁਹਾਨੂੰ ਕਰੈਕਟ ਫਿੱਗਰ ਦੇਣੇ ਆ ਫੋਰ ਫਿੱਗਰ ਵੀ ਹੋ ਸਕਦਾ ਉਹ ਸਿਕਸ ਫਿੱਗਰ ਵੀ ਇਹ ਮੈਪ ਦੇ ਉੱਤੇ ਤੁਸੀਂ ਦੇਖਿਆ ਸਾਰਾ ਕੁਛ ਉਹ ਸਾਰਾ ਕੁਛ ਕੀ ਹੈ ਇਹਦੇ ਨਾਲ ਸਾਨੂੰ ਜਿਵੇਂ ਓਨ ਪਜੀਸ਼ਨ ਅਸੀਂ ਲੱਭਣੀ ਹੈ ਆਪਣੀ ਵੀ ਕਿੱਥੇ ਖੜ੍ਹੇ ਐਂ ਅਸੀਂ ਇਹ ਜੀ ਪੀ ਐੱਸ ਦੀ ਮਦਦ ਦੇ ਨਾਲ ਅਸੀਂ ਦੇਖ ਸਕਦੇ ਐ ਹੋਰ ਕਾਫ਼ੀ ਐਪਾਂ ਨੇ ਜਿਹੜੀਆਂ ਕਿ ਸਾਨੂੰ ਨੈਵੀਗੇਸ਼ਨ ਕਰਨ ਲਈ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਜਾਣ ਲਈ ਸਾਡੇ ਜੀਵਨ ਨੂੰ ਬਹੁਤ ਹੀ ਇਨ੍ਹਾਂ ਨੇ ਅਸਾਨ ਬਣਾਇਆ ਬਹੁਤ ਬਹੁਤ ਧੰਨਵਾਦ ਜੀ